ਪੰਜਾਬ ਵਿੱਚ ਪ੍ਰਮੁੱਖ ਟੈਕਨੋਜੀ ਉਤਪਾਦ ਦੀਆਂ ਕਈ ਸੇਵਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਨ ਜ ਤਕਨੋਲਜੀ ਦੀਆਂ ਕਈ ਸੇਵਾਵਾਂ ਹਨ ਜੋ ਵੱਖ ਵੱਖ ਖੇਤਰਾਂ ਵਿੱਚ ਸੂਚਨਾ ਅਤੇ ਪ੍ਰਬੰਧਕ ਸੰਚਾਰ ਅਤੇ ਸੁਰਖੀਆਂ ਵਿੱਚ ਮਦਦ ਕਰਦੀਆਂ ਹਨ ਹੇਠਾਂ ਕੁਛ ਪ੍ਰਬੰਧਕ ਇਹ ਜਿੱਦਾਂ ਕੰਪਿਊਟਰ ਸਾਇੰਸ ਸ ਕੰਪਿਊਟਰ ਸਾਇੰਸ ਵਿੱਚ ਸੋਫਟਵੇਅਰ ਸੋਫਟਵੇਅਰ ਐਪਲੀਕੇਸ਼ਨ ਬਣਾਉਣ ਅਤੇ ਵਿਕਸਿਤ ਕਰਨ ਲਈ ਸਹਾਇਕ ਹੁੰਦੀ ਹੈ ਅਤੇ ਇਹਦੇ ਨਾਲ ਸੋਫਟਵੇਅਰ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਇਹ ਪੰਜਾਬ ਵਿੱਚ ਇਹ ਸੇਵਾ ਦਿੱਤੀ ਜਾਂਦੀ ਹੈ ਡਾਟਾ ਸਾਇੰਸ ਡਾਟਾ ਸਾਇੰਸ ਦਾ ਵਿਸ਼ਲੇਸ਼ਣ ਕਰਨ ਡਾਟਾ ਮਾਡਲ ਬਣਾਉਣ ਅਤੇ ਮਸ਼ੀਨ ਲਰਨਿੰਗ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਸੋਫਟਵੇਅਰ ਦੀ ਵੀ ਪੰਜਾਬ ਵਿੱਚ ਅੱਛੀ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਐਪ ਲੈ ਕੇ ਉੱਥੋਂ ਐਪ ਬਣਾਉਣੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਨ ਵਾਸਤੇ ਪੰਜਾਬ 'ਚ ਸੋਫਟਵੇਅਰ ਹਾਰਡਵੇਅਰ 'ਤੇ ਸਲਾਹ ਦੀ ਵਰਤੋਂ ਕੀਤੀ ਜਾਂਦੀ ਹੈ ਮਨੇਜਮੈਂਟ ਮਨੇਜਮੈਂਟ ਇਨਫੋਰਮੇਸ਼ਨ ਸਿਸਟਮ ਪ੍ਰਬੰਧਕ ਲਈ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਇਹ ਸਿਸਟਮ ਦਾ ਯੂਜ਼ ਕੀਤਾ ਜਾਂਦਾ ਹੈ ਇਹ ਸਿਸਟਮ ਯੂਜ਼ ਕਰਨ ਨਾਲ ਤਕਨੀਕ ਆਸਾਨ ਹੋ ਜਾਂਦੀ ਹੈ ਨੈਟਵਰਕ ਨੈਟਵਰਕ ਪ ਨੈਟਵਰਕ ਵੀ ਬਹੁਤ ਮਾਇਨੇ ਰੱਖਦਾ ਹੈ ਕਈ ਕੰਪਨੀਆਂ ਆਪਣਾ ਨੈਟਵਰਕ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਪੰਜਾਬ ਵਿੱਚ ਨੈਟਵਰਕਿੰਗ ਵਾਸਤੇ ਆਸਾਨੀ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ